ਮੈਨੂੰ ਪਤਾ ਲੱਗਿਆ ਆਪਣੇ ਤੇਰੇ ਕੋਲ ਇੱਕ ਕਾਰ ਹੈ ਅਤੇ ਮੈਂ ਸੋਚਿਆ ਕਿ ਘਰਦਿਆਂ ਨੂੰ ਅੰਬਰਸਰ ਘੁੰਮਾ ਕੇ ਲਿਆਉਣਾ ਅਤੇ ਉੱਥੇ ਅੰਬਰਸਰ ਮੱਥਾ ਟੇਕਾ ਕੇ ਰਸਤੇ ਵਿੱਚ ਜਿਹੜੇ ਵੀ ਗੁਰੂ ਘਰ ਦੇ ਗੁਰਦੁਆਰੇ ਆਉਂਦੇ ਹਨ ਉਹਨਾਂ ਦਾ ਮੱਥਾ ਟੇਕਾ ਕੇ ਫਿਰ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਹੈ ਰ ਜੋ ਵੀ ਤੁਹਾਡਾ ਕਿਰਾਇਆ ਬਣਦਾ ਹੋਊਗਾ ਉਹ ਆਪਾਂ ਦੇ ਦੇਵਾਂਗੇ ਜਿਸ ਤੋਂ ਬਾਅਦ ਦੇ ਦੇਵਾਂਗੇ ਅਤੇ ਪੈਸੇ ਦੀ ਤੁਸੀਂ ਪਰਵਾਹ ਨਹੀਂ ਕਰਨੀ ਹੈਗੀ ਠੀਕ ਹੈ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੱਥਾ ਟਿਕਾਉਣਾ ਮੱਥਾ ਟੇਕਾ ਕੇ ਠੀਕ ਹੈ ਰਸਤੇ ਵਿੱਚ ਜਿੰਨੇ ਵੀ ਗੁਰਦੁਆਰੇ ਆਉਂਦੇ ਆ ਭਾਈ ਉਹਨਾਂ 'ਚ ਜਾਣਾ ਮੱਥਾ ਟਿਕਾਉਣਾ ਠੀਕ ਠਾਕ ਸ਼ਾਮ ਨੂੰ ਇਹਨਾਂ ਨੂੰ ਘਰ ਪਹੁੰਚਾਉਣਾ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ